ਹਾਂ ਮੈਨੂੰ ਲਿਖਣਾ ਬਹੁਤ ਪਸੰਦ ਹੈ ਮੈਨੂੰ ਲਿਖਣ ਦਾ ਸ਼ੌਂਕ ਹੈ ਇਸ ਲਈ ਜਦੋਂ ਵੀ ਵਿਹਲਾ ਟਾਈਮ ਹੁੰਦਾ ਤਾਂ ਮੈਂ ਲਿਖਦੀ ਹਾਂ ਮੇਰੇ ਕੋਲ ਇੱਕ ਰੋਲ ਮਾਡਲ ਵੀ ਹੈ ਜੋ ਕਿ ਭਾਈ ਵੀਰ ਸਿੰਘ ਜੀ ਹਨ ਪਰ ਪਰ ਪਰ ਪਰੰਪਰਾਗਤ ਵ ਸਵਦੇਸੀ ਸਿੱਖਿਆ ਅਤੇ ਆਧੁਨਿਕ ਅੰਗਰੇਜ਼ੀ ਸਿੱਖਿਆ ਦੋਵਾਂ ਦਾ ਲਾਭ ਮਿਲਿਆ ਉਸ ਨੇ ਧਰਮ ਗ੍ਰੰਥ ਦੇ ਨਾਲ ਨਾਲ ਫਾਰਸੀ ਉਰਦੂ ਅਤੇ ਸੰਸਕ੍ਰਿਤ ਵੀ ਲਿਖੀ ਫਿਰ ਉਸ ਨੇ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਅਤੇ ਅਠਾਰ੍ਹਾਂ ਸੌ ਇੱਕਨਾਵੇਂ ਵਿੱਚ ਆਪਣੀ ਦਸਵੀਂ ਦੀ ਪ੍ਰੀਖਿਆ ਦਿੱਤੀ ਅਤੇ ਜ਼ਿਲ੍ਹੇ ਵਿੱਚ ਪਹਿਲੇ ਸਥਾਨ 'ਤੇ ਰਿਹਾ ਭਾਈ ਵੀਰ ਸਿੰਘ ਦੀਆਂ ਕੁਝ ਪ੍ਰਸਿੱਧ ਨਾਵਲ ਹਨ ਵਿਜੇ ਸਿੰਘ ਸਤਵੰਤ ਕੌਰ ਉਹਨਾਂ ਉਹਨਾਂ ਦੀਆਂ ਕਾਵੀ ਰਚਨਾਵਾਂ ਰਾਣਾ ਸੂਤਰ ਸਿੰਘ ਤਰ ਤਰੇਲ ਤੁਪਕੇ ਲਹਿਰਾਂ ਦੇ ਹਾਰ ਮਤਕ ਹੁਲਾਰੇ ਬਿਜਲੀਆਂ ਬਿਜਲੀਆਂ ਦੇ ਹਾਰ ਅਤੇ ਮੇਰੇ ਸਾਈਆਂ ਜਿਉਂ ਇਹ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਹਨ ਜੋ ਕਿ ਬਹੁਤ ਮਸ਼ਹੂਰ ਹਨ ਮੈਨੂੰ ਇਹਨਾਂ ਕਵਿਤਾਵਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਲਈ ਮੈਂ ਵੱਧ ਤੋਂ ਵੱਧ ਮਿਹਨਤ ਕਰਦੀ ਹਾਂ ਤਾਂ ਕਿ ਮੈਂ ਉੱਚਾ ਅਹੁਦਾ ਪ੍ਰਾਪਤ ਕਰ ਸਕਾਂ